ਸਿੱਖਿਆ ਰੁਜ਼ਗਾਰ ਅਤੇ ਸਮਾਜਿਕ ਸਥਿਤੀ ਦੇ ਰੂਪ ਵਿੱਚ ਰੂਪਨਗਰ ਜ਼ਿਲ੍ਹੇ ਵਿੱਚ ਔਰਤਾਂ ਦੇ ਸਾਹਮਣੇ ਇਸ ਵਕਤ ਕੋਈ ਵੀ ਇਹੋ ਜਿਹੀ ਚੁਣੌਤੀ ਨਹੀਂ ਹੈ ਜਿਨ੍ਹਾਂ ਦਾ ਉਹ ਸਾਹਮਣਾ ਨਾ ਕਰ ਸਕਣ ਹਰ ਇੱਕ ਚੀਜ਼ 'ਚ ਚਾਹੇ ਉਹ ਲਿੰਗ ਸਮਾਨਤਾ ਹੈ ਜਾਂ ਕੋਈ ਸਸ਼ਕਤੀਕਰਨ ਹੈਗਾ ਹੈ ਸਭ ਵਿੱਚ ਉਹਨਾਂ ਨੂੰ ਇੱਕ ਮੁੰਡੇ ਵਾਂਗੂੰ ਹੀ ਰੱਖਿਆ ਜਾਂਦਾ ਹੈ ਕਿ ਕੋਈ ਭੇਦਭਾਵ ਨਹੀਂ ਕੁੜੀ ਮੁੰਡੇ ਦੇ ਵਿੱਚ ਕੋਈ ਵੀ ਫਰਕ ਨਹੀਂ ਕੀਤਾ ਜਾਂਦਾ ਅੱਜ ਉਹ ਟਾਈਮ ਆ ਗਿਆ ਕਿ ਉਹ ਵਕਤ ਆ ਗਿਆ ਜਦ ਕੁੜੀ ਅਤੇ ਮੁੰਡਾ ਆਪਸ ਵਿੱਚ ਮੋਢਾ ਮਿਲਾ ਕੇ ਚੱਲਦੇ ਹਨ ਅੱਜ ਜਿੱਥੇ ਇੱਕ ਤੁਸੀਂ ਮੁੰਡਾ ਡਾਕਟਰ ਦੇਖੋਂਗੇ ਜਾਂ ਨਰਸ ਦੇਖੋਂਗੇ ਉੱਥੇ ਤੁਹਾਨੂੰ ਕੁੜੀ ਵੀ ਦਿਖੇਗੀ ਅੱਜ ਕੱਲ੍ਹ ਕੁੜੀਆਂ ਦੀ ਰੇਸ਼ੋ ਮੁੰਡਿਆਂ ਨਾਲੋਂ ਜ਼ਿਆਦਾ ਵੱਧ ਗਈ ਹੈ ਤੁਸੀਂ ਹਰ ਖੇਤਰ ਦੇ ਵਿੱਚ ਜਿਹੜੀ ਹੈ ਕੁੜੀਆਂ ਦਾ ਵਾਧਾ ਹੀ ਦੇਖੋਂਗੇ ਜਿੱਥੇ ਉਹ ਕੰਮ ਕਰ ਰਹੀਆਂ ਹਨ